ਹਾਂਜੀ ਇੱਕ ਵਾਰ ਨਾ ਮੈਂ ਆਪਣੇ ਮਿੱਟੀ ਲਿਆ ਕੇ ਮਿੱਟੀ ਨੂੰ ਮੈਂ ਮੈਂ ਮੈਂ ਕਈ ਦਿਨ ਮੱਧ ਕੇ ਰੱਖ ਲਿਆ ਤਾਂ ਉਹਦੇ ਵਿੱਚ ਰੀਣ ਪਾ ਲਈ ਮੈਂ ਤੂੜੀ ਛਾਣ ਕੇ ਤੂੜੀ ਦਾ ਜਿਹੜਾ ਛਾਣਾ ਜਿਹਾ ਹੁੰਦਾ ਨਾ ਉਹ ਪਾ ਕੇ ਉਹ ਬਹੁਤ ਵਧੀਆ ਮਿੱਟੀ ਬਣ ਗਈ ਉਸ ਮਿੱਟੀ ਨੂੰ ਮੋਲਡ ਕਰਕੇ ਐਂ ਪੂਰਾ ਵਧੀਆ ਇੱਕ ਗਣੇਸ਼ ਦੀ ਮੂਰਤੀ ਬਣਾਈ ਅਤੇ ਮੂਰਤੀ ਉਹ ਇੰਨੀ ਵਧੀਆ ਬਣੀ ਨਾ ਫਿਰ ਉਹਦੇ ਐਂ ਵੀ ਮੈਨੂੰ ਲੱਗ ਤਾਂ ਗਏ ਦੋ ਤਿੰਨ ਦਿਨ ਬਣਾਉਣ 'ਤੇ ਉਹਨੂੰ ਪੂਰੀ ਵਧੀਆ ਬਣੀ ਰੰਗ ਰੁੰਗ ਕਰਕੇ ਠੀਕ ਹੈ ਨਾ ਉਹ ਮੂਰਤੀ ਬਣਾ ਕੇ ਮੈਂ ਰੱਖ ਲਈ ਅਤੇ ਜਦੋਂ ਕੀ ਹੈ ਨਾ ਇੱਕ ਮੇਰੀ ਭੂਆ ਆਈ ਤਾਂ ਉਹ ਮੈਨੂੰ ਕਹਿੰਦੀ ਆਹ ਮੂਰਤੀ ਤਾਂ ਭਈ ਬਾਹਲੀ ਵਧੀਆ ਹੈਗੀ ਤਾਂ ਉਹ ਜਿਹੜੀ ਮੇਰੀ ਭੂਆ ਜੀ ਲੈ ਗਏ ਤਾਂ ਉਹ ਮੂਰਤੀ ਦਾ ਮੈਨੂੰ ਇੰਨੇ ਸ਼ੋਂਕ ਦੇ ਨਾਲ ਮੈਂ ਬਣਾਈ ਸੀਗੀ ਅਤੇ ਉਹ ਕਹਿੰਦੇ ਵੀ ਭਾਈ ਤੂੰ ਤਾਂ ਹੋਰ ਵੀ ਬਣਾ ਲਏਂਗਾ ਵੀ ਆ ਮੂਰਤੀ ਤਾਂ ਤੂੰ ਸਾਨੂੰ ਹੀ ਦੇਦੇ ਮੇਰਾ ਦੇਣ ਨੂੰ ਜੀ ਵੀ ਕਰਦਾ ਸੀ ਅਤੇ ਨਹੀਂ ਵੀ ਚੱਲ ਫਿਰ ਮੈਂ ਦੇ ਦਿੱਤੀ ਉਹਨਾਂ ਨੂੰ ਮੂਰਤੀ ਅਤੇ ਮੈਂ ਕਿਹਾ ਚੱਲ ਮੈਂ ਤਾਂ ਆਪਣੇ ਆਪ ਹੋਰ ਬਣਾ ਲੂੰਗਾ ਉਹ ਮੂਰਤੀ ਇੰਨੀ ਵਧੀਆ ਬਣੀ ਉਹ ਲੱਗਦੀ ਨਹੀਂ ਸੀ ਮਿੱਟੀ ਤੋਂ ਬਣੀ ਹੋਈ ਆ ਕਿਉਂਕਿ ਉਹਨੂੰ ਮੈਂ ਡੈਕੋਰੇਟ ਹੀ ਇੰਨਾ ਵਧੀਆ ਕਰਤਾ ਸੋਹਣੇ ਸੋਹਣੇ ਰੰਗ ਭਰ ਕੇ ਪੂਰੇ ਵਧੀਆ ਐਂ ਲੱਗਦੇ ਵੀ ਮੂੰਹੋਂ ਬੋਲਦੀ ਸੀ ਲੋਕ ਖੜ੍ਹ ਖੜ੍ਹ ਦੇਖਦੇ ਸੀ ਇੰਨੀ ਘੈਂਟ ਗਣੇਸ਼ ਜੀਆਂ ਦੀ ਮੂਰਤੀ ਬਣੀ ਸੀਗੀ ਅਤੇ ਚੱਲੋ ਫਿਰ ਉਹ ਤਾਂ ਮੈਂ ਉਹਨਾਂ ਨੂੰ ਦੇ ਦਿੱਤੀ ਫਿਰ ਉਸਤੋਂ ਬਾਅਦ ਮੇਰੀ ਮਾਸੀ ਨੂੰ ਵੀ ਮੈਂ ਬਣਾ ਕੇ ਦਿੱਤੀ ਹੋਰ ਸਾਡੇ ਕਈ ਰਿਸ਼ਤੇਦਾਰ ਮੇਰੇ ਤੋਂ ਉਹ ਮੂਰਤੀਆਂ ਬਣਵਾ ਕੇ ਲੈ ਕੇ ਗਏ ਮੈਨੂੰ ਮੂਰਤੀਆਂ ਬਣਾਉਣ ਦਾ ਨਾ ਬਹੁਤ ਜ਼ਿਆਦਾ ਸ਼ੌਂਕ ਹੈਗਾ ਉਸ ਤੋਂ ਇਲਾਵਾ ਮੈਂ ਉਸ ਮਿੱਟੀ ਦੇ ਮੈਂ ਮੱਝਾਂ ਘੋੜੇ ਠੀਕ ਹੈ ਜੀ ਹੋਰ ਕਈ ਚੀਜ਼ਾਂ ਬਣਾ ਲੈਂਦਾ ਸ਼ੇਰ ਬਣਾ ਲੈਂਦਾ ਮਿੱਟੀ ਦਾ ਮੈਂ ਅਤੇ ਇੱਕ ਵਾਰ ਮੈਂ ਊਠ ਬਣਾਇਆ ਮਿੱਟੀ ਦਾ ਊਠ ਬੋਲਦੇ ਹਾਂ ਜਿਹਨੂੰ ਆਪਾਂ ਤਾਂ ਮੈਨੂੰ ਜਿਹੜਾ ਗਾ ਹੱਥੀ ਜਿਹੜੇ ਉਹ ਬਣਾਉਣੇ ਨਾ ਖਿਡੌਣੇ ਜਿਹੇ ਬਹੁਤ ਵਧੀਆ ਲੱਗਦੇ ਮੂਰਤੀਆਂ ਹੋ ਗਈਆਂ ਖਿਡੌਣੇ ਹੋ ਗਏ ਅਤੇ ਸਾਰੇ ਉਹ ਪਸੰਦ ਕਰਦੇ ਹੈਗੇ ਉਹ ਐਂ ਪੂਰੇ ਵਧੀਆ ਬਣ ਜਾਂਦੇ ਹੈਗੇ ਅਤੇ ਮੇਰੇ ਕੋਲ ਕਾਫ਼ੀ ਪਏ ਵੀ ਨੇ ਤੁਸੀਂ ਦੇਖ ਵੀ ਸਕਦੇ ਹੋ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ